ਸਾਡੇ ਭਾਰਤ ਵਿੱਚ ਗਰਮੀਆਂ ਦਾ ਮੌਸਮ ਹੈ ਇੱਥੇ ਉਨਤਾਲੀ ਡਿਗਰੀ ਸੈਲਸੀਅਸ ਤਾਪਮਾਨ ਹੈ ਭਾਰਤ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਗਰਮੀ ਕਾਰਨ ਪ ਪਸ਼ੂ ਪੰਛੀ ਅਤੇ ਇਨਸਾਨ ਸਭ ਪਰੇਸ਼ਾਨ ਹੋ ਗਏ ਹਨ ਮੀਂਹ ਵੀ ਨਹੀਂ ਪੈ ਰਿਹਾ ਪਰ ਦੇਸ਼ ਦੇ ਕਈ ਖੇਤਰਾਂ ਵਿੱਚ ਮੌਸਮ ਅਲੱਗ ਅਲੱਗ ਹੁੰਦਾ ਹੈ ਜਿਵੇਂ ਕਿਸੇ ਥਾਂ 'ਤੇ ਜ਼ਿਆਦਾ ਰੁੱਖ ਰੁੱਖਾਂ ਕਾਰਨ ਤਾਪਮਾਨ ਘੱਟ ਹੁੰਦਾ ਹੈ ਅਤੇ ਕਿਸੇ ਥਾਂ 'ਤੇ ਮੀਂਹ ਪੈਣ ਕਾਰਨ ਮੌਸਮ ਠੰਡਾ ਹੋ ਜਾਂਦਾ ਹੈ ਵੱਖ ਵੱਖ ਖੇਤਰਾਂ ਵਿੱਚ ਮੌਸਮ ਵੱਖਰਾ ਵੱਖਰਾ ਹੁੰਦਾ ਹੈ ਜਿਵੇਂ ਕਈ ਥਾਵਾਂ 'ਤੇ ਮੀਂਹ ਪੈਂਦਾ ਹੈ ਅਤੇ ਕਈ ਥਾਵਾਂ 'ਤੇ ਬੱਦਲਵਾਈ ਹਨੇਰੀ ਤੂਫ਼ਾਨੀ ਥੋੜ੍ਹੇ ਜਿਹੇ ਬੱਦਲ ਹੁੰਦੇ ਹਨ ਕਈ ਥਾਵਾਂ 'ਤੇ ਬਰਫ਼ ਵੀ ਪੈਂਦੀ ਹੈ ਜਿੱਥੇ ਜ਼ਿਆਦਾ ਪਹਾੜੀ ਇਲਾਕੇ ਹੁੰਦੇ ਹਨ ਉਹ ਉੱਥੇ ਰੁੱਖਾਂ ਕਰਕੇ ਹਵਾ ਵੀ ਚੱਲਦੀ ਰਹਿੰਦੀ ਹੈ ਸਾਡੇ ਭਾਰਤ ਤੋਂ ਬਿਨਾਂ ਵੀ ਹੋਰ ਕਈ ਖੇਤਰਾਂ ਵਿੱਚ ਗਰਮੀ ਜ਼ਿਆਦਾ ਪੈਂਦੀ ਹੈ ਇੰਨਾ ਜ ਇੰਨਾ ਜ਼ਿਆਦਾ ਤਾਪਮਾਨ ਹੋਣ ਕਰਕੇ ਕਈ ਖੇਤਰਾਂ ਵਿੱਚ ਸੋਕਾ ਵੀ ਪੈ ਜਾਂਦਾ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਮੌਸਮ ਵਧੀਆ ਰਹੇ